ਪਾਣੀ ਦੀ ਸਾਡੇ ਜੀਵਨ ਵਿੱਚ ਬਹੁਤ ਮਹੱਤਤਾ ਹੈ ਪਾਣੀ ਤੋਂ ਬਿਨਾਂ ਕੋਈ ਜੀਵ ਜੰਤੂ ਪਾਣੀ ਤੋਂ ਬਿਨਾਂ ਕੋਈ ਇਨਸਾਨ ਜੀਵਿਤ ਨਹੀਂ ਰਹਿ ਸਕਦਾ ਲੋਕ ਪੁਰਾਣੇ ਟਾਈਮ ਤੇ ਪਾਣੀ ਦੀ ਵਰਤੋਂ ਕਰਨ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਉਬਾਲਦੇ ਸੀ ਕੁਝ ਲੋਕ ਪਾਣੀ ਨੂੰ ਉਬਾਲਣ ਦਾ ਵੱਖ ਵੱਖ ਤਰੀਕਾ ਅਪਣਾਉਂਦੇ ਸੀ ਕੁਝ ਲੋਕ ਪਾਣੀ ਨੂੰ ਉਬਾਲਣ ਸਮੇਂ ਤਿੰਨ ਕੱਪੜੇ ਦਾ ਯੂਜ ਕਰਦੇ ਸਨ ਜਦੋਂ ਤਿੰਨ ਕੱਪੜੇ ਦਾ ਵਰਤੋਂ ਕਰਨ ਤੋਂ ਬਾਅਦ ਉਹ ਪਾਣੀ ਦਾ ਨਿਚਲਾ ਹਿੱਸਾ ਸੁੱਟ ਕੇ ਤੇ ਛਾਣ ਕੇ ਉਸਨੂੰ ਪੀਆ ਜਾਂਦਾ ਸੀ ਲ ਲੋਕ ਪਾਣੀ ਦੀ ਵਰਤੋਂ ਖੇਤਾਂ ਵਿੱਚ ਕਰਦੇ ਹਨ ਘਰਾਂ ਵਿੱਚ ਕਰਦੇ ਹਨ ਹਰ ਕੰਮ ਦਾ ਪਾਣੀ ਦੇ ਨਾਲ ਸੰਬੰਧਿਤ ਹੁੰਦਾ ਸੀ ਕੁਝ ਲੋਕ ਅੱਜ ਕੱਲ ਐਕਵਾ ਗਾਰਡ ਪਿਓਰੀਫਾਈ ਕਾਫੀ ਚੀਜ਼ਾਂ ਲਗਵਾਉਂਦੇ ਹਨ ਪਰ ਪੁਰਾਣੇ ਸਮੇਂ ਵਿੱਚ ਲੋਕ ਪਾਣੀ ਨੂੰ ਉਬਾਲਣ ਵਾਸਤੇ ਤਿੰਨ ਕੱਪੜੇ ਦਾ ਵਰਤੋਂ ਕਰਦੇ ਸਨ ਅੱਜ ਕੱਲ ਦੇ ਜਮਾਨੇ ਵਿੱਚ ਕੁਝ ਲੋਕੀ ਪਾਣੀ ਨੂੰ ਗੈਸ ਤੇ ਉਬਾਲਣਾ ਪਸੰਦ ਕਰਦੇ ਹਨ ਪਰ ਉਬਾਲਣਾ ਪਾਣੀ ਦਾ ਮਹੱਤਵਪੂਰਨ ਹਿੱਸਾ ਹੈ ਪਾਣੀ ਦੇ ਸਾਰੇ ਕੀਟਾਣੂ ਮਰ ਜਾਂਦੇ ਹਨ ਉਬਾਲਣ ਤੋਂ ਬਾਅਦ ਇਸ ਕਰਕੇ ਉਸਨੂੰ ਉਬਾਲਣਾ ਚਾਹੀਦਾ ਹੈ ਕੁਝ ਲੋਕ ਕੁਜੇ ਦਾ ਜਾਂ ਮਿੱਟੀ ਦੇ ਭਾਂਡੇ ਦੀ ਵਰਤੋਂ ਕੀਤੀ ਜਾਂਦੀ ਸੀ ਕੁਝ ਲੋਕ ਮਿੱਟੀ ਦੇ ਬਰਤਨ ਵਿੱਚ ਉਸ ਨੂੰ ਪਾਣੀ ਨੂੰ ਕੁਝ ਦੇਰ ਰੱਖ ਕੇ ਸਵੇਰੇ ਉੱਠ ਕੇ ਖਾਲੀ ਪੇਟ ਪੀਣਾ ਪਸੰਦ ਕਰਦੇ ਸਨ ਪਾਣੀ ਸਾਡੇ ਵਾਸਤੇ ਬਹੁਤ ਜਰੂਰੀ ਹੈ